ਪਿਛਲੇ ਹਫ਼ਤੇ ਮੈਂ ਡੈੱਲ ਦਾ ਲੈਪਟੋਪ ਲਿਆ ਸੀ ਫਲਿੱਪਕਾਰਟ ਔਨਲਾਇਨ ਮਾਰਕਿਟ ਤੋਂ ਪਰ ਜਦੋਂ ਉਹ ਮੈਂ ਵਰਤਿਆ ਉਹ ਲੈਪਟੋਪ ਹੈਂਗ ਬਹੁਤ ਹੋਣ ਹੋ ਰਿਹਾ ਸੀ ਅਤੇ ਲੈਪਟੋਪ ਬਹੁਤ ਹੈਵੀ ਸੀ ਭਾਰਾ ਵੀ ਸੀ ਗਰਮ ਬਹੁਤ ਹੋ ਜਾਂਦਾ ਸੀ ਅਤੇ ਮੈਂ ਬਸ ਇਹ ਸਲਾਹ ਦੇਵਾਂਗਾ ਬਈ ਡੈੱਲ ਦਾ ਲੈਪਟੋਪ ਨਾ ਲਿਆ ਜਾਵੇ